ਕੋਵਿਡ ਨਾਈਨਟੀਨ ਇੱਕ ਬਹੁਤ ਵੱਡੀ ਮਹਾਮਾਰੀ ਹੈ ਜੋ ਸਾਡੇ ਦੇਸ਼ ਵਿੱਚ ਚਾਈਨਾ ਦੁਆਰਾ ਆਈ ਸੀ ਵਿਆਹ ਸਬੰਧੀ ਪ੍ਰਕਰਿਆ ਨੂੰ ਤੇਜ਼ੀ ਨਾਲ ਸੁਧਾਰਨ ਲਈ ਇਹ ਟੀਕਾਕਰਨ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜੋ ਕੀ ਆਪਣੇ ਸਰਕਾਰ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਇਹ ਟੀਕਾਕਰਨ ਨਾਲ ਆਪਾਂ ਕੋਵਿਡ ਤੋਂ ਬਚ ਸਕਦੇ ਹਾਂ ਤੇ ਆਪਣੇ ਸਵਾਸ ਨੂੰ ਠੀਕ ਰੱਖ ਸਕਦੇ ਹਾਂ ਇਹ ਕੈਂਪ ਸਰਕਾਰ ਦੁਆਰਾ ਆਯੋਧਿਤ ਕੀਤਾ ਜਾ ਰਿਹਾ ਹੈ ਇਹਦੀ ਸਹੂਲਤ ਲਈ ਸਾਨੂੰ ਅਧਿਕਾਰੀਆਂ ਨਾਲ ਮਿਲਣਾ ਵਰਤਣਾ ਪੈਂਦਾ ਹੈ ਜਿਸ ਕਰਕੇ ਉਹ ਸਾਨੂੰ ਦੱਸਾਂਗੇ ਕਿ ਆਪਾਂ ਕੋਵਿਡ ਟੀਕਾਕਰਨ ਦੀ ਮੁਹਿੰਮ ਨੂੰ ਕਿਵੇਂ ਆਯੋਜਿਤ ਕਰਾ ਸਕਦੇ ਹਾਂ ਇਹਦੀ ਸਲਾਹ ਬਹੁਤ ਸਾਰੇ ਲੋਕੀ ਸਾਨੂੰ ਦਿੰਦੇ ਹੈ ਕੀ ਕੋਵਿਡ ਦੇ ਟੀਕਾਕਰਨ ਕਰਾਣਾ ਬਹੁਤ ਜਰੂਰੀ ਹੋ ਗਿਆ ਹੈ ਨਾ ਕਰਾਉਣ ਤੇ ਸਾਡੇ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਇਹਨੂੰ ਸਾਂਭਣ ਲਈ ਸਾਨੂੰ ਟੀਕਾ ਕਰਨ ਦੀ ਬਹੁਤ ਆਯੋਜਿਤ ਹੋ ਸਕਦੇ ਹਨ ਇਹਨੂੰ ਆਯੋਜਿਤ ਕਰਾਣ ਲਈ ਸਾਨੂੰ ਸਰਕਾਰ ਦੇ ਪੋਰਟਲ ਤੇ ਪਿੰਡੋ ਰਜਿਸਟਰ ਹੋਣਾ ਪੈਣਾ ਹੈ ਉਸ ਤੋਂ ਬਾਅਦ ਆਪਣਾ ਟੀਕਾਕਰਨ ਸਬੰਧੀ ਆਪਾਂ ਕ੍ਰਿਆਵਾਂ ਨੂੰ ਸ਼ੁਰੂ ਕਰ ਸਕਦੇ ਹਾਂ ਇਹ ਕਿਰਿਆਵਾਂ ਆਪਾਂ ਸਰਕਾਰ ਦੀ ਅਨੁਮਤੀ ਲੈਣ ਤੋਂ ਬਾਅਦ ਹੀ ਸ਼ੁਰੂ ਕਰ ਸਕਦੇ ਹਨ ਕੋਈ ਵੀ ਅਨਜਾਨਕ ਅਧਿਕਾਰੀ ਤੁਹਾਨੂੰ ਜੇ ਟੀਕਾ ਕਰਨ ਕਰਾਉਣ ਦੀ ਸਹਾਇਤਾ ਕਰੇ ਉਹਨੂੰ ਸਾਫ ਮਨਾ ਕਰ ਦੋ ਜੇ ਤੁਹਾਨੂੰ ਸਰਕਾਰ ਵੱਲੋਂ ਕੋਈ ਵੀ ਮੈਸੇਜ ਆਵੇ ਟੀਕਾ ਕਰਾ ਉਹਨੂੰ ਸੂਚਿਤ ਕੀਤਾ ਜਾ ਰਿਹਾ ਹੈ ਉਹਨੂੰ ਧਿਆਨ ਨਾਲ ਪੜੋ ਤੇ ਆਪਣੇ ਸਿਹਤ ਨਾਲ ਕੋਈ ਵੀ ਖਲਵਾੜ ਨਾ ਕਰੋ ਇਹ ਖਲਬਾੜ ਤੁਹਾਡੀ ਸਿਹਤ ਵੀ ਭਾਰੀ ਹੋ ਸਕਦਾ ਹੈ ਅੱਜ ਹਰ ਜਗਹਾ ਇਹ ਟੀਕਾ ਕਰਾਣ ਦੀ ਟੀਮ ਬੈਠੀ ਹੋਈ ਹੈ ਜੋ ਸਾਡੇ ਆਯੋਜਿਤ ਕਰੇ ਜਾਂਦੀ ਹੈ ਕਿ ਟੀਕਾ ਕੋਵਿਡ ਸ਼ੀਲਡ ਜਾ ਕੋਵੈਕਸੀਨ ਲਗਾਈ ਜਾ ਸਕਦੀ ਹੈ